ਅਕਸਰ ਕੁਝ ਪੰਛੀ ਜਿਹੜੇ ਕਿ ਆਮ ਤੌਰ 'ਤੇ ਦਿਖਾਈ ਦਿੰਦੇ ਹਨ ਵੋ ਹਨ ਕਾਂ ਚਿੜੀ ਮੋਰ ਤੋਤਾ ਗੁਟਾਰਾ ਕਬੂਤਰ ਘੁੱਗੀਆਂ ਆਦਿ ਸਾਨੂੰ ਆਮ ਸਭ ਤੋਂ ਵਧੀਆ ਮੋਰ ਹੀ ਸਭ ਤੋਂ ਵਧੀਆ ਮੋਰ ਪੰਛੀ ਹੀ ਜਿਹੜਾ ਹੈ ਉਹ ਪਸੰਦ ਹੈ ਕਿਉਂਕਿ ਉਹਦੇ ਰੰਗ ਬਿਰੰਗੇ ਖੰਭ ਸਾਨੂੰ ਬਹੁਤ ਆਕਰਸ਼ਿਤ ਕਰਦੇ ਹਨ ਮੋਰ ਜਦੋਂ ਸਾਉਣ ਦੇ ਮਹੀਨੇ ਵਿੱਚ ਕੂਕਦਾ ਹੈ ਪੈਲਾਂ ਪਾਉਂਦਾ ਹੈ ਤਾਂ ਉਹ ਸਾਰਿਆਂ ਨੂੰ ਬਹੁਤ ਮਨਮੋਹਣਾ ਲੱਗਦਾ ਹੈ ਇਸ ਵਾਸਤੇ ਮੋਰ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਪੰਛੀ ਮੰਨਿਆ ਜਾਂਦਾ ਹੈ ਅਗਰ ਦੇਖਿਆ ਜਾਵੇ ਤਾਂ ਮੋਰ ਦੇ ਪੰ ਪੰਖਾਂ ਤੋਂ ਸੁੰਦਰ ਪੱਖੀਆਂ ਸੁੰਦਰ ਚਾਹ ਝਾੜੂ ਔਰ ਇਹਨਾਂ ਦੇ ਖੰਭਾਂ ਨੂੰ ਆਮ ਤੌਰ 'ਤੇ ਬੱਚੇ ਕਿਤਾਬਾਂ ਵਿੱਚ ਵੀ ਰੱਖਦੇ ਹਨ ਅਤੇ ਸਜਾਵਟ ਦਾ ਸ਼ਿੰਗਾਰ ਬਣਾਇਆ ਜਾਂਦਾ ਹੈ